ਸਾਡੇ ਇਲਾਕੇ ਵਿੱਚ ਪਾਣੀ ਦੇ ਵੱਖ ਵੱਖ ਤਰ੍ਹਾਂ ਦੇ ਕਈ ਸਰੋਤ ਨੇ ਜਿਵੇਂ ਕਿ ਸਤਲੁਜ ਦਰਿਆ ਉਸ ਤੋਂ ਕਈ ਨਹਿਰਾਂ ਨਿਕਲਦੀਆਂ ਹਨ ਜਿਹਨਾਂ ਦਾ ਪਾਣੀ ਸਾਨੂੰ ਜ਼ਰੂਰਤ ਅਨੁਸਾਰ ਮਿਲ ਜਾਂਦਾ ਹੈ ਸਾਡੇ ਇਲਾਕੇ ਵਿੱਚ ਪਾਣੀ ਦਾ ਬਹੁਤ ਹੀ ਜ਼ਿਆਦਾ ਵਿਕਾਸ ਹੈ ਸਾਡੇ ਇਲਾਕੇ ਵਿੱਚ ਕਈ ਤਰ੍ਹਾਂ ਦੇ ਸਮਰਸੀਬਲ ਅਤੇ ਟੋਭੇ ਹਨ ਜਿਹਨਾਂ ਦਾ ਬਰਸਾਤ ਹੋਣ ਤੋਂ ਬਾਅਦ ਪਾਣੀ ਭਰ ਜਾਂਦਾ ਹੈ ਜਿਸ ਦੀ ਵਰਤੋਂ ਅਸੀਂ ਬੜੀ ਆਸਾਨੀ ਨਾਲ਼ ਕਰ ਸਕਦੇ ਹਾਂ ਸਾਡੇ ਇਲਾਕੇ ਵਿੱਚ ਇੰਨਾ ਜ਼ਿਆਦਾ ਪਾਣੀ ਹੈ ਕਿ ਸਾਨੂੰ ਕਦੇ ਵੀ ਪਾਣੀ ਦੀ ਕਮੀ ਮਹਿਸੂਸ ਨਹੀਂ ਹੋਈ ਇਹ ਪਾਣੀ ਅਸੀਂ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ ਇਸ ਪਾਣੀ ਦਾ ਨਾਲ਼ ਸਾਡਾ ਜੀਵਨ ਬਹੁਤ ਜ਼ਿਆਦਾ ਸਫ਼ਲ ਹੋ ਰਿਹਾ ਹੈ ਇਹ ਪਾਣੀ ਸਾਨੂੰ ਜ਼ਿੰਦਗੀ ਵਿੱਚ ਬਹੁਤ ਜ਼ਰੂਰਤਾਂ ਪੂਰੀਆਂ ਕਰਦਾ ਹੈ ਇਹ ਪਾਣੀ ਹਮੇਸ਼ਾ ਹੀ ਸਾਡੇ ਇਲਾਕੇ ਵਿੱਚ ਵਹਿੰਦਾ ਹੈ ਇਸ ਪਾਣੀ ਦੀਆਂ ਬਹੁਤ ਜ਼ਿਆਦਾ ਮਹੱਤਤਾਵਾਂ ਹਨ ਵਾਟਰ ਸਪਲਾਈ ਵੀ ਹੈ ਇਸ ਪਾਣੀ ਕਾਰਨ ਸਾਨੂੰ ਬਹੁਤ ਸਾਰੀਆਂ ਸਾਡੀਆਂ ਮੰਗਾਂ ਪੂਰੀਆਂ ਹੋਈਆਂ ਹਨ ਇਸ ਪਾਣੀ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ